ਮੇਰਾ ਸਿਲਾਈ ਅਤੇ ਬੁਣ ਬੁਣਾਈ ਦੇ ਵਿੱਚ ਕਾਫ਼ੀ ਰੁਚੀ ਹੈ ਮੈਨੂੰ ਇਹ ਕੰਮ ਮੈਨੂੰ ਕਰਨ ਲੱਗਿਆਂ ਕੋਈ ਵੀ ਟਾਈਮ ਕੱਢਣ ਦੀ ਕਹਿ ਲਉ ਇੱਕ ਹਿਸਾਬ ਦੀ ਲੋੜ ਨਹੀਂ ਪੈਂਦੀ ਮੇਰਾ ਘਰ ਦਾ ਕੰਮ ਅਤੇ ਸਿਲਾਈ ਕਢਾਈ ਦਾ ਕੰਮ ਇਹਨਾਂ ਦੋਨਾਂ ਨੂੰ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਕਰ ਲੈਂਦੀ ਹਾਂ ਸਭ ਤੋਂ ਪਹਿਲੇ ਸਵੇਰੇ ਮੈਂ ਆਪਣੇ ਘਰ ਦੇ ਜੋ ਵੀ ਰੋਜ਼ ਦੇ ਕੰਮ ਹੁੰਦੇ ਆ ਉਹ ਪਹਿਲਾਂ ਮੈਂ ਕਰ ਲੈਂਦੀ ਹਾਂ ਮੇਰਾ ਸਿਲਾਈ ਦਾ ਕੰਮ ਮੈਨੂੰ ਬਹੁਤ ਖੁਸ਼ੀ ਦਿੰਦਾ ਮੈਨੂੰ ਇਹ ਕੰਮ ਕਰਕੇ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਈ ਮੈਨੂੰ ਬੜੇ ਲੋਕ ਮੇਰੇ ਕੰਮ ਦੀ ਪਰੇਜ਼ ਕਰਦੇ ਆ ਕਿ ਬੀ ਤੇਰਾ ਕੰਮ ਕਾਫ਼ੀ ਸਾਫ਼ ਹੈ ਔਰ ਮੇਰੇ ਕੋਲ ਕਾਫ਼ੀ ਲੋਕ ਆਉਂਦੇ ਆ ਸੂਟ ਸਟਿੱਚ ਕਰਾਣ ਵਾਸਤੇ ਕਈ ਤਰੀਕੇ ਦੇ ਡਿਜ਼ਾਈਨ ਪਵਾਉਂਦੇ ਆ ਔਰ ਮੈਂ ਬੜੇ ਚਾਅ ਦੇ ਨਾਲ ਪਾਉਂਦੀ ਹਾਂ ਮੈਨੂੰ ਬੜਾ ਮਜ਼ਾ ਆਉਂਦਾ ਕਿ ਹਰ ਡਿਜ਼ਾਈਨ ਨੂੰ ਨਵੇਂ ਤਰੀਕੇ ਦੇ ਨਾਲ ਕਿਵੇਂ ਅਸੀਂ ਪਾ ਸਕਦੇ ਹਾਂ ਉਹ ਪ੍ਰਜੈਕਟ ਮੈਂ ਆਪਣਾ ਚੰਗੇ ਦਿਲ ਦੇ ਨਾਲ ਕੰਪਲੀਟ ਕਰਦੀ ਹਾਂ ਅਤੇ ਲੋਕ ਮੇਰੇ ਤੋਂ ਇਸ ਗੱਲ ਤੋਂ ਪ੍ਰੇਰਿਤ ਹੋ ਕੇ ਅਤੇ ਮੈਨੂੰ ਹੋਰ ਕੰਮ ਦਿੰਦੇ ਨੇ ਅਤੇ ਮੇਰੇ ਘਰ ਦੇ ਜਿਸ ਤਰ੍ਹਾਂ ਮੇਰੇ ਬੱਚੇ ਨੇ ਮੈਂ ਉਨ੍ਹਾਂ ਲਈ ਵੀ ਪੂਰਾ ਟਾਈਮ ਕੱਢਦੀ ਹਾਂ ਮੇਰੇ ਜਿਸ ਤਰ੍ਹਾਂ ਟਾਈਮ ਕਰਨ ਦਾ ਕੰਮ ਸਵੇਰੇ ਪਹਿਲੇ ਦਸ ਤੋਂ ਇੱਕ ਹੁੰਦਾ ਫਿਰ ਤਿੰਨ ਤੋਂ ਚਾਰ ਹੁੰਦਾ ਫਿਰ ਉਸ ਤੋਂ ਬਾਅਦ ਮੇਰਾ ਕੰਮ ਛੇ ਤੋਂ ਸੱਤ ਅੱਠ ਦੇ ਵਿੱਚ ਮੈਂ ਕੰਪਲੀਟ ਕਰਦੀ ਹਾਂ ਜੇ ਮੈਨੂੰ ਕਿਤੇ ਰਾਤ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਦਾ ਅਤੇ ਮੈਂ ਜ਼ਰੂਰ ਬੜੇ ਚਾਅ ਦੇ ਨਾਲ ਕਰਦੀ ਹਾਂ ਧੰਨਵਾਦ